ਹਾਂਜੀ ਪਿਛਲੇ ਦੇ ਮਸਿਆਂ ਦੇ ਮੁਕਾਬਲੇ ਹੁਣ ਤਾਂ ਬਹੁਤ ਹੀ ਮਤਲਬ ਬਦਲ ਚੁੱਕਾ ਹੈ ਸਾਡਾ ਪਿੰਡ ਸੜਕਾਂ ਵੀ ਬਣ ਗਈਆਂ ਹੈ ਸਕੂਲ ਵੀ ਬਹੁਤ ਵਧੀਆ ਹੋ ਗਏ ਹੈ ਪਹਿਲਾਂ ਦੇ ਮੁਕਾਬਲੇ ਇਹਨਾਂ ਬੱਚਿਆਂ ਦੇ ਮਤਲਬ ਰੋਡ ਵੀ ਜਿਹੜੇ ਹੈ ਨਾ ਇੱਥੇ ਦੇ ਮਤਲਬ ਬਹੁਤ ਸਫਾਈ ਵਾਲੇ ਹੋ ਗਏ ਹੈਂ ਔਰ ਮਤਲਬ ਡਬਲ ਡਬਲ ਰੋਡ ਹੋ ਗਏ ਪਹਿਲਾਂ ਤਾਂ ਨਹੀਂ ਸੀ ਵੀ ਪਹਿਲਾਂ ਐਕਸੀਡੈਂਟ ਬਹੁਤ ਹੁੰਦੇ ਸੀ ਹੁਣ ਨਹੀਂ ਹੁੰਦੇ ਬੱਚੇ ਵੀ ਸਕੂਲ ਵਿੱਚ ਬਹੁਤ ਵਧੀਆ ਨਾਲ਼ ਪੜ੍ਹਦੇ ਹਾਂ ਇਹ ਸਕੂਲ ਵਿੱਚ ਵੈਨ ਲੱਗ ਗਈ ਬੱਚੇ ਵੈਨ 'ਤੇ ਸਕੂਲ ਜਾਂਦੇ ਐਂ ਡ੍ਰੈਸਾਂ ਬਹੁਤ ਵਧੀਆ ਵਧੀਆ ਨਾਲੇ ਟੀਚਰਸ ਵੀ ਬਹੁਤ ਪੜ੍ਹੇ ਲਿਖੇ ਐਜੂਕੇਟਿਡ ਆ ਗਏ ਇੱਥੇ ਬਹੁਤ ਵਿਕਾਸ ਹੋ ਗਿਆ ਪਹਿਲਾਂ ਨਾਲੋਂ ਤਾਂ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਇੱਥੇ ਹੁਣ ਤਾਂ ਸੜਕਾਂ ਵੀ ਬਹੁਤ ਵਧੀਆ ਵਧੀਆ ਹਰ ਜਗ੍ਹੇ ਡਸਟਬੀਨ ਬੈਠਣ ਦੀ ਜਗ੍ਹਾ ਗਰਾਊਂਡ ਮਤਲਬ ਬਹੁਤ ਵਧੀਆ